ਸਾਨੂੰ ਬਿਜਲੀ ਦੇ ਬਹੁਤ ਫਾਇਦੇ ਹੈ ਸਾਨੂੰ ਬਿਜਲੀ ਨਾਲ ਹਰੇਕ ਚੀਜ਼ ਵਾਸ਼ਿੰਗ ਮਸ਼ੀਨ ਵਗੈਰਾ ਚੀਜ਼ਾਂ ਹੈ ਸਾਨੂੰ ਬਹੁਤ ਸਹੂਲਤਾਂ ਬਿਜਲੀ ਦੀਆਂ ਹੋ ਗਈਆਂ ਠੀਕ ਹੈ ਬਿਜਲੀ ਦਾ ਡਰ ਵੀ ਹੈ ਜਿਵੇਂ ਕਰੰਟ ਲੱਗਣਾ ਨੰਗੇ ਪੈਰ ਹੋਣ ਪਾਣੀ 'ਚ ਤਾਰਾਂ ਕਿਤੇ ਛੋਟ ਕਰਦੀਆਂ ਹੋਣ ਬੱਚਿਆਂ ਦਾ ਵੀ ਡਰ ਲੱਗਦਾ ਜਿਵੇਂ ਬੱਚੇ ਨੰਗੀਆਂ ਤਾਰਾਂ ਨੂੰ ਹੱਥ ਨਾ ਲਗਾ ਲੈਣ ਨੁਕਸਾਨ ਵੀ ਸਾਨੂੁੰ ਬਹੁਤ ਹੈ ਪਰ ਫਾਇਦੇ ਵੀ ਇਹ 'ਚ ਬਹੁਤ ਜ਼ਿਆਦਾ ਨੇ ਅਸੀਂ ਆਪਣੇ ਬੱਚਿਆਂ ਦੇ ਫਾਇਦੇ ਦੇਖਣ ਲਈ ਅਤੇ ਅਸੀਂ ਬੱਚਿਆਂ ਨੂੰ ਸਮਝਾ ਸਕਦੇ ਪੁੱਤ ਨੰਗੇ ਪੈਰ ਨਹੀਂ ਜਾਣਾ ਚੱਪਲ ਪਾ ਕੇ ਸੁੱਚਾਂ ਨੂੰ ਹੱਥ ਲਗਾਉਣਾ ਜੇ ਸੁੱਚ ਨੰਗੇ ਹੋਣ ਤਾਂ ਬਿਜਲੀ ਨੂੰ ਹੱਥ ਨਹੀਂ ਲਾਉਣਾ ਆਪਾਂ ਕਿਸੇ ਹੋਰ ਚੀਜ਼ ਨਾਲ ਉਹਨੂੰ ਸੁੱਚ ਨੂੰ ਔਨ ਕਰ ਸਕਦੇ ਆਪਣੇ ਸਹੂਲਤਾਂ ਆਪ ਕਰ ਸਕਦੇ